ਪਠਾਨਕੋਟ ਦੇ ਲੋਕਾਂ ਵਿੱਚ ਆਪਸੀ ਪਿਆਰ ਹੋਣ ਕਰਕੇ ਅਤੇ ਹਰੇਕ ਧਰਮ ਦੀ ਇੱਜਤ ਕਰਦੇ ਹੋਣ ਕਰਕੇ ਪਠਾਨਕੋਟ ਵਿੱਚ ਹਰੇਕ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਵੇਂ ਦਿਵਾਲੀ ਦੁਸਹਿਰਾ ਹੋਲੀ ਈਦ ਗੁਰਪੁਰਬ ਕ੍ਰਿਸਮਸ ਅਤੇ ਅਨੇਕਾਂ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਆਪਸੀ ਪਿਆਰ ਨਾਲ ਮਿਲ ਜੁਲ ਕੇ ਮਨਾਏ ਜਾਂਦੇ ਹਨ ਪਠਾਨਕੋਟ ਦੀ ਲੋਹੜੀ ਬੜੀ ਹੀ ਮਸ਼ਹੂਰ ਹੈ ਲੋਹੜੀ ਵਾਲੇ ਦਿਨ ਪਠਾਨਕੋਟ ਵਿੱਚ ਹੀ ਲੋਕ ਬੜੇ ਹੀ ਜੋਸ਼ੀਲੇ ਨਜ਼ਰ ਆਉਂਦੇ ਹਨ ਇਸ ਦਿਨ ਲੋਕ ਪਤੰਗਬਾਜ਼ੀ ਕਰਦੇ ਹਨ ਅਤੇ ਨਾਚ ਗਾਣਾ ਵੀ ਕਰਦੇ ਹਨ ਖ਼ਾਸ ਕਰਕੇ ਨਵ ਵਿਆਹੀ ਜੋੜੇ ਅਤੇ ਨਵ ਜਨਮੇ ਜੁਆਕਾਂ ਦੇ ਘਰ

ਇਸ ਤੋਂ ਇਲਾਵਾ ਪਠਾਨਕੋਟ ਦੀ ਦਿਵਾਲੀ ਅਤੇ ਸ਼ਿਵਰਾਤਰੀ ਵੀ ਬੜੀ ਮਸ਼ਹੂਰ ਹੈ ਪਠਾਨਕੋਟ ਦੀ ਸ਼ਿਵਰਾਤਰੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇਸ ਲਈ ਪਠਾਨਕੋਟ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਜੋ ਕਿ ਪਠਾਨਕੋਟ ਦੀ ਸਭ ਸ਼ੋਭਾ ਯਾਤਰਾਵਾਂ ਨਾਲੋਂ ਸਭ ਤੋਂ ਵੱਡੀ ਸ਼ੋਭਾ ਯਾਤਰਾ ਹੈ ਇਸ ਵਿੱਚ ਰੱਬ ਦੇ ਤਰ੍ਹਾਂ ਤਰ੍ਹਾਂ ਦੇ ਸਭ ਰੂਪ ਬਣਾਏ ਜਾਂਦੇ ਹਨ ਅਤੇ ਲੋਕਾਂ ਨੂੰ ਸਨਾਤਨੀ ਸਨਾਤਨ ਧਰਮ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਪਠਾਨਕੋਟ ਵਿੱਚ ਗੁਰਪੁਰਬ ਕ੍ਰਿਸਮਸ ਈਦ ਸਾਰੇ ਤਿਉਹਾਰ ਬੜੇ ਹੀ ਮਿਲ ਜੁਲ ਕੇ ਮਨਾਏ ਜਾਂਦੇ ਹਨ ਪਠਾਨਕੋਟ ਦੇ ਲੋਕਾਂ ਵਿੱਚ ਆਪਸੀ ਪਿਆਰ ਬਹੁਤ ਹੈ ਇਸ ਕਰਕੇ ਹਰੇਕ ਧਰਮ ਦੀ ਇੱਜਤ ਕਰਦੇ ਹਨ ਪਠਾਨਕੋਟ ਦੇ ਲੋਕ ਬੜੇ ਹੀ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਂਦੇ ਹਨ ਅਤੇ ਹਰੇਕ ਧਰਮ ਦੀ ਇੱਜਤ ਕਰਦੇ ਹਨ ਪਠਾਨਕੋਟ ਦੇ ਲੋਕ ਹਰ ਤਿਉਹਾਰ 'ਤੇ ਬੜੇ ਹੀ ਜੋਸ਼ੀਲੇ ਨਜ਼ਰ ਆਉਂਦੇ ਹਨ ਹਾਲਾਂਕਿ ਮਨਾਏ ਗਈ ਹੋਲੀ ਵੀ ਪਠਾਨਕੋਟ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਈ ਗਈ ਹੈ ਇਸ ਦਿਨ ਲੋਕ ਬੜੇ ਜੋਸ਼ੀਲੇ ਨਜ਼ਰ ਆਉਂਦੇ ਹਨ ਅਤੇ ਹਰੇਕ ਨੂੰ ਰੰਗ ਲਾਉਂਦੇ ਹਨ ਅਤੇ ਹੋਲੀ ਖੇਡਦੇ ਹਨ ਫੁੱਲਾਂ ਦੀ ਹੋਲੀ ਰੰਗਾਂ ਦੀ ਹੋਲੀ ਪਾਣੀ ਦੀ ਹੋਲੀ ਅਤੇ ਹਰੇਕ ਹੋਲੀ ਖੇਡਦੇ ਹਨ ਪਠਾਨਕੋਟ ਵਿੱਚ ਹਰੇਕ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ